ਜੀ ਹਾਂ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸ ਸਕਦਾ ਹੈ ਕਿ ਐਲ ਪੀ ਜੀ ਸਿਲਿੰਡਰ ਦੀ ਵਰਤੋਂ ਕਰਦੇ ਸਮੇਂ ਸਾਨੂੰ ਕੀ ਕੀ ਸੁਰੱਖਿਆਵਾਂ ਰੱਖਣੀਆਂ ਚਾਹੀਦੀਆਂ ਹਨ ਸਾਰਿਆਂ ਤੋਂ ਪਹਿਲੀ ਤਾਂ ਇਹ ਹੈ ਕਿ ਜਦੋਂ ਵੀ ਆਪਾਂ ਖਾਣਾ ਬਣਾਉਣਾ ਹੈ ਤਾਂ ਖਾਣਾ ਬਣਾਉਣ ਤੋਂ ਬਾਅਦ ਆਪਾਂ ਜਿਹੜੇ ਵੀ ਗੈਸ ਹੈ ਉਹਨੂੰ ਚੰਗੀ ਤਰ੍ਹਾਂ ਆਪਾਂ ਉਹਨੂੰ ਬੰਦ ਕਰਕੇ ਜਾਈਏ ਕਿਉਂਕਿ ਜਦ ਜੇ ਆਪਾਂ ਉਹਨੂੰ ਨਾ ਬੰਦ ਕੀਤਾ ਚੰਗੀ ਤਰ੍ਹਾਂ ਤਾਂ ਜਦੋਂ ਆਪਾਂ ਅਗਲੀ ਵਾਰ ਕਦੇ ਵੀ ਆਵਾਂਗੇ ਉਹ ਗੈਸ ਉਸ ਟਾਈਮ ਦੇ ਉੱਪਰ ਇੰਨੀ ਜ਼ਿਆਦਾ ਫੈਲ ਚੁੱਕੀ ਹੋਵੇਗੀ ਨਾ ਸਾਡੇ ਘਰ ਦੇ ਵਿੱਚ ਕਿ ਆਪਾਂ ਮਾੜੀ ਜਿਹੀ ਤੀਲੀ ਜਿੱਦਾਂ ਹੀ ਲਗਾਈ ਜਾਂ ਆਪਾਂ ਆਪ ਨਾ ਵੀ ਲਗਾਈ ਕਿਸੇ ਹੋਰ ਥੋੜ੍ਹੀ ਦੂਰ ਉਹਦੇ ਤੋਂ ਜਾਂ ਕੇ ਆਪਾਂ ਕਿਤੇ ਕੋਈ ਉਦਾਂ ਹੀ ਅੱਗ ਬਾਲ ਦਿੱਤੀ ਤਾਂ ਉਹ ਅੱਗ ਨੇ ਫੜ੍ਹ ਲੈਣੀ ਸਾਰੇ ਘਰ ਨੇ ਉਹ ਗੈਸ ਨੇ ਫੜ੍ਹ ਲੈਣੀ ਤਾਂ ਇਸ ਦੇ ਨਾਲ ਸਾਰੇ ਘਰ ਦੇ ਵਿੱਚ ਹਾਦਸਾ ਹੋਣ ਦਾ ਬਹੁਤ ਵੱਡਾ ਖ਼ਤਰਾ ਹੈ ਦੂਸਰਾ ਇਹ ਹੈ ਵੀ ਆਪਾਂ ਜਿੰਨੀ ਵੀ ਦੂਰ ਜਿੰਨਾ ਆਪਾਂ ਆਪਣਾ ਸਲੰਡਰ ਹੈ ਜਿਹੜਾ ਆਪਣੇ ਘਰ ਤੋਂ ਬਾਹਰਲੇ ਗਾਰਡਨ ਦੇ ਵਿੱਚ ਜਾਂ ਉਹਨੂੰ ਆਪਾਂ ਅੰਡਰਗਰਾਊਂਡ ਰੱਖਣ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਕੋਈ ਵੀ ਜੇ ਦੁਰਘਟਨਾ ਘਟੇ ਤਾਂ ਘਰ ਦੇ ਬਾਹਰ ਹੀ ਘਟੇ ਘਰ ਨੂੰ ਕੋਈ ਨੁਕਸਾਨ ਨਾ ਹੋਵੇ